ਅਗਰ ਗੱਲ ਕੀਤੀ ਜਾਵੇ ਮੁੱਖ ਫਸਲਾਂ ਦੀ ਤਾਂ ਭਾਰਤ ਵਿੱਚ ਜਾਂ ਪੰਜਾਬ ਵਿੱਚ ਅਗਰ ਸਭ ਤੋਂ ਮੇਨ ਫਸਲਾਂ ਜੋ ਕਿ ਹਰੇਕ ਕਿਸਾਨ ਦੁਆਰਾ ਉਗਾਈਆਂ ਜਾਂਦੀਆਂ ਅਤੇ ਜਿਨ੍ਹਾਂ ਨੂੰ ਕਿਸਾਨ ਉਹਨਾਂ ਫਸਲਾਂ ਨੂੰ ਉਗਾਉਣਾ ਪਸੰਦ ਵੀ ਕਰਦੇ ਹਨ ਇਹਨਾਂ ਵਿੱਚ ਇੱਕ ਤਾਂ ਕਣਕ ਹੈ ਜਿਹੜੀ ਕਣਕ ਆਮ ਤੌਰ 'ਤੇ ਉਗਾਈ ਜਾਂਦੀ ਹੈ ਅਤੇ ਕ ਕਿਸਾਨਾਂ ਦੁਆਰਾ ਪਸੰਦ ਵੀ ਕੀਤੀ ਜਾਂਦੀ ਹੈ ਕਿ ਉਹ ਇਸ ਫਸਲ ਨੂੰ ਉਗਾਉਣ ਕਿਉਂਕਿ ਕਣਕ ਜੋ ਹਰੇਕ ਕਿਸਾਨ ਆਸਾਨੀ ਨਾਲ ਉਗਾ ਸਕਦਾ ਹੈ ਕਣਕ ਹੋਰ ਜਿਵੇਂ ਕਿ ਹੋਰ ਫਸਲ ਲਈ ਜਾਵੇ ਤਾਂ ਜਿਵੇਂ ਕੀ ਝੋਨਾ ਝੋਨਾ ਵੀ ਕਿਸਾਨਾਂ ਦੁਆਰਾ ਖੁਸ਼ੀ ਤੌਰ 'ਤੇ ਲਗਾਇਆ ਜਾਂਦਾ ਹੈ ਝੋਨਾ ਵੀ ਭਾਰਤ ਵਿੱਚ ਆਮ ਤੌਰ 'ਤੇ ਹਰੇਕ ਇਲਾਕੇ ਵਿੱਚ ਝੋਨਾ ਉਗਾਇਆ ਜਾਂਦਾ ਜੋ ਕਿ ਗਰਮ ਇਲਾਕਿਆਂ ਨੂੰ ਉਹਨਾਂ ਵਿੱਚ ਝੋਨਾ ਪਸ ਕਿਸਾਨਾਂ ਦੀ ਇੱਕ ਪਸੰਦਤਾ ਹੈ ਕਿ ਝੋਨੇ ਨੂੰ ਉਗਾਉਣਾ ਇਸ ਤੋਂ ਇਲਾਵਾ ਕਿਸਾਨਾਂ ਦੁਆਰਾ ਫਰੂ ਫਲਾਂ ਦੀ ਖੇਤੀ ਕਰਨੀ ਜਿਵੇਂ ਕਿ ਅਮਰੂਦ ਦੀ ਖੇਤੀ ਕਰਨੀ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ